ਹਾਂ ਮੇਰੇ ਚੱਲਣ ਅਤੇ ਖੇਡਣ ਵਾਲੇ ਜੁੱਤੇ ਬਹੁਤ ਅਲੱਗ ਹਨ ਮੈਂ ਉਹਨਾਂ ਵਿੱਚ ਕਾਫੀ ਆਰਾਮ ਨਾਲ ਖੇਡ ਸਕਦਾ ਹਾਂ ਅਤੇ ਭੱਜ ਸਕਦਾ ਹਾਂ ਮੈਨੂੰ ਉਹਨਾਂ ਵਿੱਚ ਹੀ ਆਰਾਮ ਮਿਲਦਾ ਹੈ ਮੈਂ ਹੋਰ ਕੋਈ ਜੁੱਤੇ ਪਾ ਕੇ ਨਹੀਂ ਖੇਡ ਸਕਦਾ ਇਸੇ ਤਰ੍ਹਾਂ ਮੇਰੇ ਖੇਡਣ ਦੇ ਕੱਪੜੇ ਵੀ ਅਲੱਗ ਹਨ ਮੇਰੇ ਮੈਂ ਆਪਣੇ ਖੇਡਣ ਲਈ ਅਲੱਗ ਅਤੇ ਟਰੈਕਸੂਟ ਜਾਂ ਹੋਰ ਇੱਕ ਟੀਸ਼ਰਟ ਰੱਖੀਆਂ ਹੋਈਆਂ ਹਨ ਜਿਨਾਂ ਵਿੱਚ ਹੀ ਮੈਂ ਆਰਾਮ ਨਾਲ ਖੇਡ ਸਕਦਾ ਹਾਂ ਮੈਂ ਜੀਨ ਜਾਂ ਵਗੈਰਾ ਹੋਰ ਚੀਜ਼ਾਂ ਪਾ ਕੇ ਨਹੀਂ ਖੇਡ ਸਕਦਾ